ਹੈਲੋ ਮੈਂ ਰਾਹੀਲ ਮਸੀ ਬੋਲ ਰਹੀ ਹਾਂ ਕੀ ਤੁਸੀਂ ਨਟਰਾਜ ਰੈਸਟੋਰੈਂਟ ਤੋਂ ਗੱਲ ਕਰ ਰਹੇ ਹੋ ਅਤੇ ਮੈਂ ਕੱਲ੍ਹ ਰਾਤ ਤੁਹਾਡੇ ਹੋਟਲ ਕੋਲੋਂ ਖਾਣਾ ਓਰਡਰ ਕਰਵਾਇਆ ਸੀ ਅਤੇ ਜਿਸ ਬਾਰੇ ਮੈਂ ਤੁਹਾਨੂੰ ਸ਼ਿਕਾਇਤ ਕਰਨਾ ਚਾਹੁੰਦੀ ਹਾਂ ਕਿ ਜੋ ਖਾਣੇ ਵਿੱਚ ਮੈਂ ਸ਼ਾਹੀ ਪਨੀਰ ਦਾਲ ਮੱਖਣੀ ਰੋਟੀ ਅਤੇ ਮਿੱਠੇ ਵਿੱਚ ਰਸਮਲਾਈ ਮੰਗਵਾਈ ਸੀ ਅਤੇ ਉਸ ਵਿੱਚ ਜੋ ਹੈ ਬਹੁਤ ਕਮੀਆਂ ਸੀ ਸ਼ਾਹੀ ਪਨੀਰ ਵਿੱਚ ਜੋ ਮਸਾਲੇ ਪੈਂਦੇ ਹੈ ਉਹ ਵੀ ਠੀਕ ਢੰਗ ਨਾਲ ਤੁਸੀਂ ਨਹੀਂ ਪਾਏ ਸੀ ਅਤੇ ਦਾਲ ਮੱਖਣੀ ਵਿੱਚ ਵੀ ਨਮਕ ਬਹੁਤ ਹੀ ਘੱਟ ਸੀਗਾ ਜਿਸ ਕਾਰਨ ਉਹਦਾ ਕੋਈ ਸੁਆਦ ਨਹੀਂ ਆਇਆ ਅਤੇ ਜੋ ਰੋਟੀ ਸੀਗੀ ਉਹ ਵੀ ਬਹੁਤ ਹੀ ਸਖ਼ਤ ਸੀ ਅਤੇ ਜੋ ਰਸਮਲਾਈ ਸੀਗੀ ਉਹਦੇ ਵਿੱਚ ਵੀ ਤੁਸੀਂ ਮਿੱਠਾ ਜੋ ਹੈ ਸਹੀ ਮਾਤਰਾ ਵਿੱਚ ਨਹੀਂ ਪਾਇਆ ਸੀ ਜਿਹਦੇ ਕਾਰਨ ਉਸ ਨੂੰ ਖਾਣ ਵਿੱਚ ਵੀ ਬਹੁਤ ਅੱਛਾ ਨਹੀਂ ਲੱਗਿਆ ਅਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੇਰੀ ਸ਼ਿਕਾਇਤ ਨੂੰ ਦਰਜ ਕਰੋ ਅਤੇ ਅੱਗੇ ਨੂੰ ਧਿਆਨ ਰੱਖਦੇ ਹੋਏ ਆਪਣੀ ਜੋ ਹੈ ਖਾਣ ਵਾਲੀ ਸਮੱਗਰੀ ਵਿੱਚ ਸੁਧਾਰ ਕਰੋ ਤਾਂ ਕਿ ਅਸੀਂ ਅੱਗੇ ਨੂੰ ਵੀ ਤੁਹਾਡੇ ਕੋਲੋਂ ਹੀ ਓਰਡਰ ਕਰ ਸਕੀਏ ਧੰਨਵਾਦ ਜੀ